ਹਾਂਜੀ ਮੈਂ ਪਿਛਲੇ ਸਮੇਂ ਵਿੱਚ ਰੇਲ ਗੱਡੀ ਰਾਹੀਂ ਕੁਰਾਲੀ ਸ਼ਹਿਰ ਤੋਂ ਲੈ ਕੇ ਸ਼੍ਰੀ ਆਨੰਦਪੁਰ ਸਾਹਿਬ ਸ਼ਹਿਰ ਤੱਕ ਯਾਤਰਾ ਕੀਤੀ ਹੈ ਅਤੇ ਇਸ ਯਾਤਰਾ ਦੌਰਾਨ ਮੈਂ ਦੱਸਣਾ ਚਾਹੁੰਦਾ ਹਾਂ ਕਿ ਰੇਲ ਗੱਡੀ ਦੀਆਂ ਸੀਟਾਂ ਕੁਛ ਵਧੀਆ ਤਰੀਕੇ ਨਾਲ਼ ਨਹੀਂ ਸਨ ਅਤੇ ਸਾਡੀਆਂ ਰੇਲ ਗੱਡੀਆਂ ਵਿੱਚ ਬਹੁਤ ਸਾਰੀਆਂ ਕਮੀਆਂ ਦੇਖੀਆਂ ਜਾ ਸਕਦੀਆਂ ਹਨ ਜਿਨ੍ਹਾਂ ਨੂੰ ਕਿ ਦੂਰ ਕਰਨਾ ਚਾਹੀਦਾ ਹੈ ਇਹਨਾਂ ਦੇ ਇੰਜਣ ਸ਼ੌਰ ਸ਼ਰਾਬਾ ਪਹੀਏ ਟਰੈਕ ਪ੍ਰੋਪਰ ਤਰੀਕੇ ਨਾਲ਼ ਨਹੀਂ ਕੰਮ ਕਰ ਰਹੇ ਅਤੇ ਇਸ 'ਤੇ ਸਰਕਾਰ ਵੀ ਕੁਛ ਖ਼ਾਸ ਧਿਆਨ ਨਹੀਂ ਦੇ ਰਹੀ